ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤ ਨੇ ਸਾਡੇ ਜੀਵਨ 'ਤੇ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਅੱਜ ਤੋਂ ਦਸ ਸਾਲ ਪਹਿਲਾਂ ਜੋ ਜਦੋਂ ਆਪਾਂ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਜਾਂਦੇ ਸੀ ਉਸ ਸਮੇਂ ਸੌ ਰੁਪਏ ਦੇ ਪੈਟਰੋਲ ਦੇ ਨਾਲ ਸਾਡਾ ਇੱਕ ਹਫਤਾ ਜਾਂ ਦੋ ਹਫਤੇ ਲੰਘ ਜਾਂਦੇ ਸੀ ਆਰਾਮ ਨਾਲ ਅਤੇ ਅਸੀਂ ਡਿਊਟੀ 'ਤੇ ਜਾਣ ਆਉਣ ਜਾਣ ਨੂੰ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰ ਜਦੋਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਪੈਟਰੋਲ ਪੰਪ ਦੇ ਨੇੜੇ ਜਾਂਦੇ ਹਾਂ ਤਾਂ ਇੱਕ ਝਟਕਾ ਜਿਹਾ ਲੱਗਦਾ ਹੈ ਸਾਡੀ ਜੇਬ 'ਤੇ ਇਸ ਤਾਂ ਬਹੁਤ ਹੀ ਬੁਰਾ ਅਸਰ ਪਿਆ ਪ੍ਰਭਾਵ ਪਿਆ ਹੈ ਖਰਚਾ ਬਹੁਤ ਯਾਨੀ ਵੱਧ ਚੁੱਕਿਆ ਪੈਟਰੋਲ ਦਾ ਚਲੋ ਸਰਕਾਰ ਦੇ ਵੀ ਉਪਰਾਲੇ ਚੰਗੇ ਨੇ ਜਿਹੜੇ ਹੁਣ ਇਲੈਕਟਰਿਕ ਬਾਈਕ ਲੈ ਕੇ ਆ ਰਹੇ ਨੇ ਇਲੈਕਟਰਿਕ ਗੱਡੀਆਂ ਦਾ ਜੋ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਉਹ ਵੀ ਸਰਕਾਰ ਦਾ ਬਹੁਤ ਹੀ ਇੱਕ ਵਧੀਆ ਉਪਰਾਲਾ ਹੈ ਪਰ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਕਿ ਪੈਟਰੋਲ ਦੀਆਂ ਕੀਮਤਾਂ ਨੂੰ ਵੀ ਸੀਮਿਤ ਕੀਤਾ ਜਾਵੇ ਤਾਂ ਕਿ ਜੋ ਮਿਡਲ ਵਰਗ ਔਰ ਗਰੀਬ ਵਰਗ ਦੇ ਲੋਕ ਡਿਊਟੀ ਜਾਣ ਦੌਰਾਨ ਆਪਣੀ ਬਾਈਕ ਦਾ ਇਸਤੇਮਾਲ ਕਰ ਸਕਣ ਬਾਲਣ ਜੋ ਲੱਕੜ ਦੀ ਵਰਤੋਂ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਹੈ ਬੜਾ ਹੀ ਨੁਕਸਾਨਦੇਹ ਹੈ ਇਸ ਦੇ ਨਾਲ ਬਹੁਤ ਹੀ ਬਿਮਾਰੀਆਂ ਫੈਲ ਰਹੀਆਂ ਹੈ ਧੂੰਆਂ ਜਿਵੇਂ ਕਿ ਅੱਜ ਕੱਲ੍ਹ ਕਿਸਾਨ ਵੀ ਪਰਾਲੀ ਪਰੂਲੀ ਬਾਲਣ 'ਤੇ ਸਰਕਾਰ ਕਾਫੀ ਪੁਲਿਸ ਕੇਸ ਵਗੈਰਾ ਬਣਾ ਰਹੀ ਹੈ ਔਰ ਇਹਦੇ 'ਤੇ ਸੁਧਾਰ ਲਈ ਕਾਫੀ ਪ੍ਰੋਗਰਾਮ ਲਿਆਏ ਜਾ ਰਹੇ ਹਨ ਇਹ ਵੀ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਚਲੋ ਆਪਾਂ ਇਹ ਕਹਿੰਦੇ ਸਰਕਾਰ ਨੂੰ ਇਸ 'ਤੇ ਵੀ ਕੋਈ ਵਧੀਆ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਕਿ ਬਾਲਣ ਦੇ ਨਾਲ ਕਈ ਵਾਰੀ ਤਾਂ ਰੋਡ ਐਕਸੀਡੈਂਟ ਦੇ ਵੀ ਕਾਰਨ ਬਣੇ ਨੇ ਜਿਹੜੇ ਪਰਾਲੀ ਵਾਲੇ ਧੂੰਏ ਅਤੇ ਹੋਰ ਵੀ ਅੱਗ ਲੱਗ ਜਾਂਦੀ ਹੈ ਜਿਹੜੀ ਗਰਮੀਆਂ ਦੌਰਾਨ ਸੜਕ ਦੇ ਦੌਰਾਨ ਜਿਹੜੇ ਖੜ੍ਹੇ ਦਰੱਖਤ ਜਾਂ ਸੁੱਕੇ ਪੱਤੇ ਜਾਂ ਕੋਈ ਬੀੜੀ ਸਿਗਰਟ ਪੀਂਦਾ ਹੋਇਆ ਬੰਦਾ ਕੋਲੋਂ ਲੰਘਦਾ ਹੋਵੇ ਉਹ ਨਹੀਂ ਬੁਝਾਉਂਦਾ ਉਸ ਦੇ ਨਾ ਕਾਰਨ ਵੀ ਅੱਗ ਲੱਗਣ ਦੇ ਕਈ ਕਾਰਨ ਹੋ ਜਾਂਦੇ ਅਤੇ ਬਾਲਣ ਦਾ ਤਾਂ ਲਾਈ ਸਾਡੀ ਜੀਵਨ 'ਤੇ ਬਹੁਤ ਹੀ ਬੁਰਾ ਪ੍ਰਭਾਵ ਹੈ